ਹੈਲੋ ਸਤਿ ਸ਼੍ਰੀ ਅਕਾਲ ਮੈਮ ਆਸ਼ਾ ਰਾਣੀ ਮੈਮ ਗੱਲ ਕਰ ਰਹੇ ਹੋ ਹਾਂਜੀ ਮੈਮ ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਇੱਥੋ ਫੇਮਸ ਗਾਈਡ ਹੋ ਮਤਲਬ ਕਿ ਟੂਰੇਸਟ ਗਾਈਡ ਹੋ ਮੈਮ ਮੈਂ ਜਿੱਦਾਂ ਇੱਥੇ ਪੰਜਾਬ ਵਿੱਚ ਆਈ ਹਾਂ ਨਵੀਂ ਨਵੀਂ ਇੱਥੇ ਦੇ ਫੇਮਸ ਪਲੇਸ ਦੱਸੋਂਗੇ ਕਿਹੜੇ ਕਿਹੜੇ ਆ ਹਾਂਜੀ ਹਾਂਜੀ ਮੈਮ ਅਸੀਂ ਅੰਮ੍ਰਿਤਸਰ ਬਾਰੇ ਸੋਚਿਆ ਵੀ ਇੱਥੇ ਘੁੰਮ ਫਿਰ ਕੇ ਆਵਾਂਗੇ ਇਹਨਾਂ ਬਾਰੇ ਕੁਝ ਦੱਸੋਂਗੇ ਹਾਂਜੀ ਇੱਥੇ ਰਹਿਣ ਸਹਿਣ ਬਾਰੇ ਹਾਂਜੀ ਅਤੇ ਕੋਈ ਰੈਂਟ ਵਗੈਰਾ ਹਾਂਜੀ ਓਕੇ ਜੀ ਹਾਂਜੀ ਮੈਮ ਓਕੇ ਮੈਮ ਓਕੇ ਠੀਕ ਓਕੇ ਥੈਂਕ ਯੂ